ਹਾਂਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਰਨ ਟੂਰ ਐਂਡ ਟਰੈਵਲ ਤੋਂ ਬੋਲਦੇ ਜੀ ਹਾਂਜੀ ਸਾਹਿਬ ਮੈਂ ਹਰਦੀਪ ਸਿੰਘ ਗਹੁਣ ਬੋਲ ਰਿਹਾ ਮੈਂ ਤੁਹਾਡੀ ਟੈਕਸੀ ਜਿਹੜੀ ਇਹ ਗੱਡੀ ਬੁੱਕ ਕਰਵਾਈ ਸੀਗੀ ਪਰ ਅਜੇ ਤੱਕ ਉਹ ਪਹੁੰਚੀ ਨਹੀਂ ਹੈ ਜੀ ਮੈਂ ਇਸ ਵੇਲੇ ਚੰਡੀਗੜ੍ਹ ਚੌਂਕ ਦੇ ਵਿੱਚ ਖੜ੍ਹਾ ਜੀ ਨਵਾਂਸ਼ਹਿਰ ਮੈਂ ਇੱਥੇ ਬਸ ਸੱਦੀ ਸੀ ਪਰ ਉਹ ਅਜੇ ਤੱਕ ਜਿਹੜਾ ਡਰਾਈਵਰ ਆ ਤੁਹਾਡਾ ਪਹੁੰਚਿਆ ਨਹੀਂ ਮੈਂ ਜਦੋਂ ਉਹਨੂੰ ਵਾਰ ਵਾਰ ਫ਼ੋਨ ਕਰ ਰਿਹਾ ਤਾਂ ਉਹ ਕਹਿ ਰਿਹਾ ਵੀ ਮੈਂ ਆ ਰਿਹਾ ਹਾਂ ਪਰ ਲੱਗਦਾ ਉਹ ਕਿ ਟ੍ਰੈਫਿਕ 'ਚ ਹੀ ਕਿਤੇ ਫਸਿਆ ਹੋਇਆ ਅਤੇ ਮੈਂ ਅੱਗੇ ਜਾਣ ਨੂੰ ਜਿਹੜਾ ਉਹ ਲੇਟ ਹੋ ਰਿਹਾ ਹਾਂ ਅਤੇ ਹੁਣ ਮੈਂ ਇੱਥੇ ਆਪਣੇ ਦੋਸਤ ਨੂੰ ਰਿਕੁਐਸਟ ਕੀਤੀ ਹੈ ਇਹ ਇੱਥੇ ਆ ਗਏ ਨੇ ਅਤੇ ਹੁਣ ਮੈਂ ਇਹਨਾਂ ਨਾਲ ਚੱਲਿਆ ਹਾਂ ਅਤੇ ਪਲੀਸ ਸਮੇਂ ਸਿਰ ਪਹੁੰਚਣਾ ਹੁੰਦਾ ਅੱਗੇ ਤੋਂ ਜੇ ਤੁਹਾਡੀ ਬੁੱਕ ਕਰਵਾਉ ਤਾਂ ਜਾਂ ਤਾਂ ਕਲੀਅਰ ਦੱਸ ਦਿਉ ਵੀ ਕਦੋਂ ਤੱਕ ਪਹੁੰਚਣਾ ਆ ਕਿਉਂਕਿ ਮੈਂ ਕਾਫੀ ਅੱਧੇ ਘੰਟੇ ਤੋਂ ਪਰੇਸ਼ਾਨ ਹੋ ਰਿਹਾ ਡਰਾਈਵਰ ਮੈਨੂੰ ਕਹਿ ਰਿਹਾ ਮੈਂ ਆ ਰਿਹਾਂ ਪਰ ਅਜੇ ਤੱਕ ਉਹ ਪਹੁੰਚਿਆ ਨਹੀਂ ਅਤੇ ਹੁਣ ਮੈਨੂੰ ਮਜ਼ਬੂਰ ਹੋ ਕੇ ਆਪਣੇ ਦੋਸਤ ਨੂੰ ਜਿਹੜੀ ਰਿਕੁਐਸਟ ਕਰਨੀ ਪਈ ਹੈ ਅਤੇ ਹੁਣ ਮੈਂ ਇਸ ਇਹਦੇ ਨਾਲ ਜਾ ਰਿਹਾ ਹਾਂ ਅਤੇ ਇਹ ਤੁਹਾਨੂੰ ਬੇਨਤੀ ਜ਼ਰੂਰ ਕਰੂੰਗਾ ਵੀ ਅੱਗੇ ਵਾਸਤੇ ਕਲੀਅਰ ਦੱਸਿਆ ਕਰੋ ਜੇ ਨਹੀਂ ਵੀ ਆਉਣਾ ਹੁੰਦਾ ਜੋ ਕਿ ਅਸੀਂ ਤੁਹਾਡੀ ਹੀ ਸਰਵਿਸ ਲੈਦੇ ਹਾਂ ਸਰਵਿਸ ਤੁਹਾਡੀ ਵਧੀਆ ਆ ਪਰ ਕਦੀ ਕਦੀ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਪਰੇਸ਼ਾਨੀ ਆਉਂਦੀ ਇਹ ਨਾ ਆਵੇ ਇਹ ਆਸ ਰੱਖਦੇ ਹਾਂ ਅਤੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਅਤੇ ਹੁਣ ਤੁਹਾਡੀ ਕੈਂ ਕੈਂਸਲ ਕਰਦੇ ਹਾਂ ਅਤੇ ਮੈਂ ਆਪਣੇ ਦੋਸਤ ਨਾਲ ਜਾ ਰਿਹਾ ਜੀ